ਜਿਹੜੇ ਕਿ ਮਤਲਬ ਵਾਕ ਵਿੱਚ ਜਿਹੜੇ ਵਰਤੇ ਗਏ ਵਿਆਕਰਨਕ ਵ ਵਰਗ ਹੁੰਦੇ ਨੇ ਜਿਵੇਂ ਨਾਂਵ ਹੋ ਗਿਆ ਵਿਸ਼ੇੇਸ਼ਣ ਹੋ ਗਿਆ ਕਿਰਿਆ ਹੋ ਗਿਆ ਉਹਨਾਂ ਦੇ ਜਿਹੜੇ ਮਤਲਬ ਸੂਚਕ ਸਮੂਹ ਹੁੰਦਾ ਜਾਂ ਫਿਰ ਜਿਹੜਾ ਸ਼ਬਦ ਸਮੂਹ ਹੁੰਦਾ ਉਸਨੂੰ ਮੇਨ ਆਪਾਂ ਵਾਕੰਸ਼ ਕਹਿੰਦੇ ਜਿਵੇਂ ਕਿ ਆਪਾਂ ਆਮ ਜ਼ਿੰਦਗੀ ਦੇ ਵਿੱਚ ਵਰਤਦੇ ਹੀ ਹਾਂ ਜਿਵੇਂ ਕਾਕਾ ਰੋਇਆ ਮਤਲਬ ਕਾਕਾ ਕੀ ਹੋ ਗਿਆ ਇੱਥੇ ਵੀ ਹਾਂ ਵੀ ਨਾਂਵ ਵਾਕੰਸ਼ ਹੋ ਗਿਆ ਵੀ ਉਹ ਉਹਦਾ ਮਤਲਬ ਜਿਹੜਾ ਉਹ ਕਿਰਿਆ ਕੀ ਕਰ ਰਿਹਾ ਉਹ ਰੋ ਰਿਹਾ ਦੋ ਪ੍ਰਕਾਰ ਦੇ ਹੋ ਜਾਂਦੇ ਨੇ ਵਾਕੰਸ਼ ਜਿਵੇਂ ਨਾਂਵ ਵਾਕੰਸ਼ ਹੋ ਗਿਆ ਕਿਰਿਆ ਕਿਰਿਆ ਵਾਕੰਸ਼ ਹੋ ਗਿਆ ਅਤੇ ਜਿਹਦਾ ਨਾਂਵ ਵਰਗ ਜਦੋਂ ਕਾਰਜ ਨਿਭਾਂਦਾ ਨਿਭਾਉਂਦਾ ਹੈ ਤਾਂ ਉਸ ਨੂੰ ਨਾਂਵ ਵਾਕੰਸ਼ ਕਹਿੰਦੇ ਨੇ ਜਿਵੇਂ ਕਿ ਆਪਾਂ ਕਹਿ ਦਿੰਦੇ ਹਾਂ ਵੀ ਬੱਚੇ ਸਕੂਲ ਗਏ ਹੈ ਨਾ ਇੱਕ ਸ਼ਬਦ ਦਾ ਵੀ ਹੋ ਸਕਦਾ ਜਾਂ ਫਿਰ ਇਹ ਸਮੂਹ ਵੀ ਹੋ ਸਕਦਾ ਬੱਚਾ ਸਕੂਲ ਗਿਆ ਜਾਂ ਫਿਰ ਬ ਬੱਚੇ ਸਕੂਲ ਗਏ ਜਿਵੇਂ ਕਿ ਮੇਰੀ ਸਹੇਲੀ ਨੇ ਮੈਨੂੰ ਕਿਤਾਬ ਦਿੱਤੀ ਮਤਲਬ ਮੇਰੀ ਸਹੇਲੀ ਕੀ ਹੋ ਗਈ ਨਾਂਵ ਹੋ ਗਿਆ ਇੱਕ ਤਰ੍ਹਾਂ ਨਾਂਵ ਵਾਕੰਸ਼ ਹੋ ਗਿਆ ਉਹ ਕਿਰਿਆ ਕੀ ਕਰ ਰਹੀ ਵੀ ਉਸਨੇ ਮੈਨੂੰ ਕਿਤਾਬ ਦਿੱਤੀ ਠੀਕ ਹੈ ਸੰਬੰਧ ਹੋ ਗਿਆ ਅਤੇ ਕਾਰਜ ਦੇ ਆਧਾਰ 'ਤੇ ਵੀ ਹੁੰਦਾ ਰੂਪ ਦੇ ਆਧਾਰ 'ਤੇ ਵੀ ਹੋ ਜਾਂਦਾ ਮਤਲਬ ਹਰ ਇੱਕ ਚੀਜ਼ ਵਿੱਚ ਆਪਾਂ ਜਦੋਂ ਕੋਈ ਵੀ ਜਿਵੇਂ ਵਾਕ ਬੋਲ ਰਹੇ ਹਾਂ ਹੈ ਨਾ ਵੀ ਮੁੰਡਾ ਗਾਉਂਦਾ ਹੈ ਕੀ ਹੋ ਗਿਆ ਇਹ ਕਰਤਾ ਨਾਂਵ ਵਾਕੰਸ਼ ਹੋ ਗਿਆ ਇਸ ਤਰ੍ਹਾਂ ਮਤਲਬ ਵਾਕੰਸ਼ ਦੋ ਤਰ੍ਹਾਂ ਦੇ ਹੁੰਦੇ ਨੇ ਅਤੇ ਆਪਾਂ ਆਮ ਜ਼ਿੰਦਗੀ ਦੇ ਵਿੱਚ ਵਰਤਦੇ ਹੀ ਰਹਿੰਦੇ ਹਾਂ ਦੂਜੀ ਗੱਲ ਮੁਹਾਵਰੇ ਮੁਹਾਵਰੇ ਵੀ ਆਪਾਂ ਬਹੁਤ ਤਰ੍ਹਾਂ ਦੇ ਆਪਣੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਰਤਦੇ ਹਾਂ ਜਿਵੇਂ ਕਿ ਸਿਰ 'ਤੇ ਚੜ੍ਹਨਾ ਮਤਲਬ ਆਪਾਂ ਕਿਸੇ ਨੂੰ ਕਹਿੰਦੇ ਅਗਰ ਆਪਣਾ ਕੋਈ ਛੋਟਾ ਭਰਾ ਹੁੰਦਾ ਤਾਂ ਆਪਾਂ ਉਹਨੂੰ ਕਹਿੰਦੇ ਵੀ ਮੇਰੇ 'ਤੇ ਨਾ ਸਿਰ 'ਤੇ ਨਾ ਚੜ੍ਹ ਠੀਕ ਆ ਬਾਹਲਾ ਸਿਰ 'ਤੇ ਨਾ ਚੜ੍ਹ ਮੇਰੇ ਜਿੰਨਾ ਹੈਗਾ ਵੀ ਓਨਾ ਹੀ ਰਹਿ ਠੀਕ ਹੈ ਫਿਰ ਉਸ ਤੋਂ ਬਾਅਦ ਹੋਰ ਆ ਜਾਂਦੇ ਵੀ ਅੱਖ ਦਿਖਾਉਣਾ ਠੀਕ ਹੈ ਅਤੇ ਆਪਣੇ ਪੈਰ ਆਪ ਕੁਹਾੜਾ ਮਾਰਨਾ ਮਤਲਬ ਕਿ ਹੱਥੀਂ ਪੈਰ ਕੁਹਾੜਾ ਮਾਰਨਾ ਵੀ ਆਪਣੀ ਗਲਤੀ ਵੱਲ ਆਪ ਹੀ ਵੱਧ ਜਾਣਾ ਆਪ ਹੀ ਗਲਤੀਆਂ ਕਰਨਾ ਠੀਕ ਹੈ ਅੱਗ ਲਾਉਣੀ ਆਪਾਂ ਜਿਵੇਂ ਕੋਈ ਛੋਟੀ ਭੈਣ ਹੈ ਹੈ ਨਾ ਉਹ ਅੱਗ ਲਾ ਰਹੀ ਹੁੰਦੀ ਹੈ ਆਪਾਂ ਆਮ ਜ਼ਿੰਦਗੀ ਵਿੱਚ ਵਰਤਦੇ ਹਾਂ ਵੀ ਮੇਰੇ ਬਾਰੇ ਅੱਗ ਨਾ ਲਾ ਠੀਕ ਹੈ ਉਂਗਲ ਦਿਖਾਉਣੀ ਹੋਰ ਮੁਹਾਵਰੇ ਆਪਾਂ ਬਹੁਤ ਤਰ੍ਹਾਂ ਦੇ ਮੁਹਾਵਰੇ ਜਿਵੇਂ ਅਕਲ ਦਾ ਅੰਨ੍ਹਾ ਕਹਿ ਦਿੰਦੇ ਆਪਾਂ ਵੀ ਅਕਲ ਦਾ ਅੰਨ੍ਹਾ ਹੀ ਹੈ ਇਹ ਠੀਕ ਹੈ ਆਪਣੇ ਅੱਗੇ ਕੰਢੇ ਬੀਜਣਾ ਖੁਦ ਆਪਣੀ ਮਤਲਬ ਪਤਾ ਹੋ ਕੇ ਵੀ ਗਲਤੀ ਕਰਨੀ ਹੈ ਨਾ ਵਾਲ ਵਿੰਗਾ ਨਾ ਹੋਣ ਦੇਣਾ ਜਦੋਂ ਆਪਣਾ ਆਪਣੇ ਮਾਤਾ ਜੀ ਹੈ ਉਹ ਆਪਣਾ ਵਾਲ ਵਿੰਗਾ ਨਹੀਂ ਹੋਣ ਦਿੰਦੇ ਜਾਂ ਵੀ ਇੰਨੀ ਜ਼ਿਆਦਾ ਆਪਣੇ ਧਿਆਨ ਰੱਖਦੇ ਹੈ ਠੀਕ ਹੈ ਹੋਰ ਵੀ ਬਹੁਤ ਤਰ੍ਹਾਂ ਦੇ ਮੁਹਾਵਰੇ ਜਿਹੜੇ ਕਿ ਆਪਾਂ ਆਮ ਜ਼ਿੰਦਗੀ ਦੇ ਵਿੱਚ ਵਰਤਦੇ ਹਾਂ ਜਿਵੇਂ ਈਦ ਦਾ ਚੰਦ ਹੋਣਾ ਕਾਫੀ ਦਿਨ ਹੋ ਗਏ ਦੋਸਤ ਦਿਖਿਆ ਨਹੀਂ ਉਹਨੂੰ ਆਪਾਂ ਕਹਿੰਦੇ ਹਾਂ ਈਦ ਦਾ ਚੰਦ ਹੀ ਹੋ ਗਿਆ ਤੂੰ ਤਾਂ ਅੱਖ ਦਾ ਤਾਰਾ ਸਭ ਤੋਂ ਛੋਟਾ ਬੱਚਾ ਆਪਣੇ ਮਾਤਾ ਪਿਤਾ ਦੀ ਅੱਖ ਦਾ ਤਾਰਾ ਹੁੰਦਾ ਹੈ ਠੀਕ ਹੈ ਅੱਖ ਵਿੱਚ ਰੜਕਣਾ ਹੁਣ ਕੋਈ ਬੰਦਾ ਆਪਾਂ ਨੂੰ ਉਹ ਪਸੰਦ ਨਹੀਂ ਤਾਂ ਆਪਣੀ ਅੱਖ ਵਿੱਚ ਰੜਕਦਾ ਤਾਂ ਆਪਾਂ ਉਸ ਲਈ ਸਪੈਸ਼ਲ ਸਾਰੀ ਗੱਲ ਮੈਂਸ਼ਨ ਨਹੀਂ ਕਰਦੇ ਉਸਨੂੰ ਆਪਾਂ ਕਹਿੰਦੇ ਅੱਖ ਵਿੱਚ ਰੜਕ ਰਿਹਾ ਇਹ ਤਾਂ ਮੇਰੇ ਧੰਨਵਾਦ ਜੀ